ਪੰਜਾਬ ਅੰਦਰ ਜਿਹੜੇ ਵਹਿਮ ਆਪਣਾ ਭਰਮ ਹਨ ਉਹ ਵੀ ਸਾਨੂੰ ਇੱਕ ਜਾਣੀ ਕਿ ਪਿਛਲੇ ਸਮੇਂ ਤੋਂ ਹੀ ਚੱਲਦੇ ਆ ਰਹੇ ਹਨ ਉਹ ਵਹਿਮ ਭਰਮ ਇੱਕ ਇਹੋ ਜਿਹੀ ਦਲਦਲ ਹੈ ਜਿਹਦੇ ਅੰਦਰ ਅਸੀਂ ਜਾਣੀ ਕਿ ਫਸ ਮਕੀ ਚੁੱਕੇ ਹਾਂ ਅਤੇ ਉਹ ਵਹਿਮ ਜੋ ਅਸੀਂ ਪਾਲੇ ਹੋਏ ਹਨ ਉਹ ਸਾਡੇ ਖੁਦ ਦੇ ਪਾਲੇ ਹੋਏ ਹਨ ਅਤੇ ਜਿਹੜੇ ਇਹ ਵਹਿਮ ਨੇ ਉਹ ਵਹਿਮ ਸਾਡੇ ਦਿਮਾਗ ਅੰਦਰ ਜਾਣੀ ਕਿ ਇਸ ਤਰ੍ਹਾਂ ਆਪਣਾ ਘਰ ਚੁੱਕੇ ਹਨ ਕਿ ਉਹ ਸਾਡੇ ਦਿਮਾਗ ਵਿੱਚੋਂ ਉਹ ਕੁਛ ਗੱਲਾਂ ਹਨ ਜੋ ਨਹੀਂ ਜਾ ਸਕਦੀਆਂ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਬਿੱਲੀ ਰਸਤਾ ਆਪਣਾ ਕੱਟ ਮਕੀ ਆਪਣਾ ਜਾਣਦਾ ਸੀ ਵਹਿਮ ਉਹ ਤਾਂ ਇੱਕ ਜਾਨਵਰ ਹੈ ਜਾਨਵਰ ਨੇ ਤਾਂ ਹਰੇਕ ਜਗ੍ਹਾ ਜਾਨੀ ਕਿ ਫਿਰਨਾ ਘੁੰਮਣਾ ਕਿਉਂਕਿ ਉਹ ਇੱਕ ਕੁਦਰਤ ਦਾ ਨਿਯਮ ਹੈ ਆਪਣਾ ਨਿਯਮਾਂ ਨੇ ਅਤੇ ਹਾਂ ਇਸ ਕਰਕੇ ਜੇ ਆਪਾਂ ਉਹ ਪੁਰਾਣੀ ਸੋਚ ਦੇ ਅਨੁਸਾਰ ਚਲਾਂਗੇ ਤਾਂ ਆਪਾਂ ਸਮਾਜ ਅੰਦਰ ਅੱਗੇ ਨਹੀਂ ਜਾ ਸਕਾਂਗੇ ਅਤੇ ਜਿਹੜੇ ਵਹਿਮ ਨੇ ਕੁਝ ਵਹਿਮ ਜਿਹੜੇ ਲੋਕਾਂ ਦੇ ਵਿੱਚ ਬੜੇ ਨੇ ਵੀ ਜਾਣੀ ਕਿ ਅਸੀਂ ਆਹ ਆਪਣਾ ਟੂਣਾ ਕਰਾਂਗੇ ਜਾਂ ਆਹ ਕੁਛ ਆਪਣਾ ਚਰਸਤੇ ਅੰਦਰ ਜਾਂ ਕੁਛ ਮਾਂਜਾ ਰੱਖਾਂਗੇ ਜਾਂ ਝਾੜੂ ਰੱਖਾਂਗੇ ਜਾਂ ਕੋਈ ਮੌਲੀ ਰੱਖਾਂਗੇ ਵੀ ਸਾਡਾ ਕੰਮ ਜਾਣੀ ਕਿ ਅਛਾ ਬਣ ਜਾਏਗਾ ਅਤੇ ਉਹ ਕੰਮ ਤਾਂ ਕਰਨ ਵਾਲਾ ਉਹ ਮਾਲਕ ਹੈ ਖੁਦਾ ਹੈ ਪਰਮਾਤਮਾ ਹੈ ਆਪਾਂ ਉਸ ਪਰਮਾਤਮਾ ਅੱਗੇ ਅਰਦਾਸ ਆਪਣਾ ਕਰ ਸਕਣੇ ਹਾਂ ਬੇਨਤੀ ਕਰ ਸਕਦੇ ਹਾਂ ਵੀ ਪਰਮਾਤਮਾ ਤੋਂ ਉੱਤੇ ਆਪਣੇ ਕੋਈ ਨਹੀਂ ਹੈਗਾ ਜੇ ਆਪਾਂ ਇਹ ਵਹਿਮਾਂ ਭਰਮਾਂ ਦੇ ਵਿੱਚ ਕਰੀਏ ਜਾਂ ਵੀ ਚਰਸਤੇ ਵਿੱਚ ਮਾਂਜਾ ਖਲਾਰ ਦੇਈਏ ਜਾਂ ਕਿਤੇ ਘੜਾ ਰੱਖ ਦੇਈਏ ਵੀ ਸਾਡਾ ਕੋਈ ਕੰਮ ਸੈਟ ਅੱਛਾ ਵੀ ਹੋ ਜਾਏਗਾ ਇਹ ਤਾਂ ਇੱਕ ਆਪਣੇ ਫਾਲਤੂ ਦੇ ਵਹਿਮ ਅੱਛਾ ਵੀ ਪਾਲੇ ਹੋਏ ਨੇ ਆਪਾਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਸਾਰੇ ਪ੍ਰਨ ਕਰੀਏ ਵੀ ਆਪਾਂ ਇਹਨਾਂ ਵਹਿਮਾਂ ਭਰਨ ਭਰਮਾਂ ਦੇ ਵਿੱਚੋਂ ਨਿਕਲ ਕੇ ਵੀ ਆਪਣੀ ਜੀਵਨ ਦੇ ਵਿੱਚ ਸਫਲ ਹੋਣ ਦੇ ਲਈ ਸਮਾਜ ਦੇ ਵਿੱਚ ਵਿਚਰਨ ਦੇ ਆਪਣਾ ਅੱਛਾ ਲਵੀ ਲਈ ਆਪਾਂ ਇੱਕ ਦੂਜੇ ਨਾਲ ਮੱਤ ਭੇ ਭੇਦ ਵਿਚਾਰ ਵਟਾਂਦਰੇ ਸਭ ਜਾਣੀ ਕਿ ਦੂਰ ਆਪਣਾ ਕਰਕੇ ਇੱਕ ਪਰਮਾਤਮਾ ਦੇ ਇੱਕ ਉਸ ਅਕਾਲ ਪੁਰਖ ਦੇ ਲੜ ਲੱਗੀਏ ਜੋ ਕਿ ਸਾਨੂੰ ਸਿਹਤ ਮਕੀ ਆਪਣਾ ਦੇ ਦਿੰਦਾ ਹੈ ਇੱਕ ਨਾਲ ਆਪਣਾ ਆਪਣਾ ਜੁੜਨ ਦੀ ਅਤੇ ਤਾਂ ਜੋ ਸਾਡੇ ਜੀਵਨ ਅੰਦਰ ਜਿਹੜੀਆਂ ਬੁਰਾਈਆਂ ਨੇ ਉਹ ਖਤਮ ਹੋ ਸਕਣ ਸਾਡੇ ਜੀ ਜੀਵਨ ਅੰਦਰ ਜਦੋਂ ਗ ਬੁਰਾਈਆਂ ਖਤਮ ਹੋ ਜਾਣਗੀਆਂ ਤਾਂ ਸਾਡੇ ਜੀਵਨ ਦੇ ਵਿੱਚ ਖੁਸ਼ੀ ਆਏਗੀ ਸਾਡਾ ਜੀਵਨ ਖੁਸ਼ਹਾਲ ਹੋਏਗਾ ਜਿਸ ਨਾਲ ਵੀ ਸਾਡਾ ਸਮਾਜ ਵਿੱਚ ਵੀ ਇੱਕ ਨਾਮ ਜਾਣੀ ਕਿ ਬਣੇਗਾ ਰੁਤਬਾ ਅੱਛਾ ਵੀ ਬਣੇਗਾ ਅਤੇ ਅਸੀਂ ਆਪਣੀਆਂ ਤਰੱਕੀਆਂ ਦੇ ਰਾਹ 'ਤੇ ਵੀ ਚੱਲਾਂਗੇ